ਮੈਂ ਊਸ਼ਾ ਸਿਲਾਈ ਮਸ਼ੀਨ ਇਸਤੇਮਾਲ ਕਰਦੀ ਹਾਂ ਸ਼ੁਰੂ ਸ਼ੁਰੂ 'ਚ ਮੈਂ ਹੱਥ ਵਾਲੀ ਊਸ਼ਾ ਮਸ਼ੀਨ ਲਿਆਉਂਦੀ ਸੀਗੀ ਅਤੇ ਮੈਂ ਉਹਦੇ ਨਾਲ ਕੱਪੜੇ ਸੀਂਦੀ ਸੀਗੀ ਅਤੇ ਹੌਲੀ ਹੌਲੀ ਮੈਨੂੰ ਕੱਪੜੇ ਸੀਨੇ ਅੱਛੀ ਤਰ੍ਹਾਂ ਆਉਣ ਲੱਗੇ ਲੇਕਿਨ ਕਿਸੇ ਟਾਈਮ ਪ੍ਰੋਬਲਮ ਆ ਜਾਂਦੀ ਸੀਗੀ ਕਦੇ ਮਸ਼ੀਨ 'ਚ ਧਾਗਾ ਫਸ ਜਾਂਦਾ ਸੀ ਅਤੇ ਕਦੇ ਮਸ਼ੀਨ ਜਾਮ ਹੋ ਜਾਂਦੀ ਸੀਗੀ ਫਿਰ ਮੈਂ ਇੱਕ ਦੋ ਵਰੀ ਕਾਰੀਗਰ ਨੂੰ ਬੁਲਾ ਕੇ ਠੀਕ ਕਰਵਾਈ ਲੇਕਿਨ ਹੌਲੀ ਹੌਲੀ ਕਾਰੀਗਰ ਨੂੰ ਦੇਖ ਕੇ ਮੈਨੂੰ ਪਤਾ ਲੱਗ ਗਿਆ ਕਿ ਇਹ ਪ੍ਰੋਬਲਮ ਕਿੱਦਾਂ ਦੂਰ ਕੀਤੀ ਜਾ ਸਕਦੀ ਹੈ ਫਿਰ ਮੈਂ ਹੌਲੀ ਹੌਲੀ ਆਪੇ ਆਪਣੀ ਮਸ਼ੀਨ ਦੀ ਪ੍ਰੋਬਲਮ ਠੀਕ ਕਰ ਲੈਂਦੀ ਸੀਗੀ ਜਿੱਦਾਂ ਜਿੱਦਾਂ ਮੈਨੂੰ ਤਜੁਰਬਾ ਹੁੰਦਾ ਗਿਆ ਮੈਂ ਫਿਰ ਦੂਜੀ ਪੈਰਾਂ ਵਾਲੀ ਮਸ਼ੀਨ ਲੈ ਲਈ ਫਿਰ ਮੈਂ ਪੈਰਾਂ ਵਾਲੀ ਮਸ਼ੀਨ ਦੇ ਨਾਲ ਮੈਨੂੰ ਬਹੁਤ ਆਸਾਨੀ ਹੋਈ ਕਿਉਂਕਿ ਉਹ 'ਚ ਕੱਪੜੇ ਸੀਨ ਵਾਸਤੇ ਟਾਈਮ ਵੀ ਘੱਟ ਲੱਗਦਾ ਸੀਗਾ ਅਤੇ ਕੰਮ ਵੀ ਜਲਦੀ ਹੋ ਜਾਂਦਾ ਸੀਗਾ ਫਿਰ ਮੈਂ ਪੈਰਾਂ ਵਾਲੀ ਮਸ਼ੀਨ ਨਾਲ ਕੱਪੜੇ ਸੀਣੇ ਸ਼ੁਰੂ ਕਰ ਦਿੱਤੇ ਲੇਕਿਨ ਕਿਸੇ ਟਾਈਮ ਪੈਰਾਂ ਵਾਲੀ ਮਸ਼ੀਨ ਨਾਲ ਵੀ ਮੈਨੂੰ ਪ੍ਰੋਬਲਮ ਆ ਜਾਂਦੀ ਸੀਗੀ ਫਿਰ ਮੈਂ ਹੌਲੀ ਹੌਲੀ ਕਾਰੀਗਰ ਨੂੰ ਬੁਲਾ ਕੇ ਅਤੇ ਮਸ਼ੀਨ ਦਿਖਾ ਕੇ ਅਤੇ ਮਸ਼ੀਨ 'ਚ ਜੋ ਵੀ ਪ੍ਰੋਬਲਮ ਆਉਂਦੀ ਸੀਗੀ ਅਤੇ ਮੈਂ ਉਹਨਾਂ ਨੂੰ ਕਹਿ ਕੇ ਠੀਕ ਕਰਵਾ ਲੈਂਦੀ ਸੀਗੀ ਲੇਕਿਨ ਜਿੱਦਾਂ ਜਿੱਦਾਂ ਟਾਈਮ ਨਿਕਲਦਾ ਗਿਆ ਮੇਰੀ ਮਸ਼ੀਨ ਬਿਲਕੁਲ ਸਮੂਥਲੀ ਚੱਲਣੀ ਸ਼ੁਰੂ ਹੋ ਗਈ ਅਤੇ ਮੈਨੂੰ ਪਤਾ ਵੀ ਲੱਗਣਾ ਸ਼ੁਰੂ ਹੋ ਗਿਆ ਕਿ ਮੇਰੀ ਮਸ਼ੀਨ 'ਚ ਕਿੱਥੋਂ ਪ੍ਰੋਬਲਮ ਆ ਰਹੀ ਹੈ ਕਿ ਕੀ ਹੋ ਰਿਹਾ ਅਤੇ ਮੈਂ ਮਸ਼ੀਨ ਚਲਦੀ ਚਲਦੀ 'ਚ ਆਪੇ ਵੀ ਠੀਕ ਕਰ ਲੈਂਦੀ ਸੀ ਅਤੇ ਹੁਣ ਮੈਨੂੰ ਮਸ਼ੀਨ ਚਲਾਉਣ 'ਚ ਕੋਈ ਖਾਸ ਪ੍ਰੋਬਲਮ ਨਹੀਂ ਆਉਂਦੀ ਹੈ ਅਤੇ ਹੁਣ ਮੈਂ ਅੱਛੀ ਤਰ੍ਹਾਂ ਮਸ਼ੀਨ ਚਲਾ ਲੈਂਦੀ ਹਾਂ